ਸੰਗੀਤ ਸਾਜ਼ ਦੀ ਗੱਲ ਕਰੀਏ ਤਾਂ ਜੀ ਮੈਂ ਇਸ ਮਾਮਲੇ 'ਚ ਆਪਣੇ ਆਪ ਨੂੰ ਥੋੜ੍ਹਾ ਜਿਹਾ ਪਿੱਛੇ ਸਮਝਦੀ ਹਾਂ ਕਿਉਂਕਿ ਮੈਨੂੰ ਮੌਕਾ ਨਹੀਂ ਮਿਲਿਆ ਕਦੇ ਸਾਜ਼ ਸਿੱਖਣ ਦਾ ਪਰ ਮੇਰਾ ਦਿਲ ਬਹੁਤ ਕਰਦਾ ਵੀ ਮੈਂ ਸਿੱਖਾਂ ਅਤੇ ਮੈਂ ਹਰਮੋਨੀਅਮ ਸਿੱਖਣਾ ਚਾਹੂੰਗੀ ਕਿਉਂਕਿ ਮੈਨੂੰ ਬੜਾ ਵਧੀਆ ਲੱਗਦਾ ਮੈਂ ਆਪਣੀ ਜਿਹੜੀ ਇੱਛਾ ਹੈ ਆਪਣੇ ਬੇਟੇ ਰਾਹੀਂ ਪੂਰੀ ਕਰ ਰਹੀ ਹਾਂ ਅਤੇ ਮੈਂ ਹੁਣ ਵੀ ਕਹਿੰਦੀ ਹਾਂ ਵੀ ਜ਼ਿੰਦਗੀ 'ਚ ਕਦੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਹਰਮੋਨੀਅਮ ਸਿੱਖ ਕੇ ਉਹਦੇ 'ਤੇ ਆਪਣਾ ਸ਼ਬਦ ਗਾਉਣਾ ਚਾਹੂੰਗੀ ਅਤੇ ਇਹਦੇ ਨਾਲ ਕੀ ਆ ਵੀ ਆਪਣੀ ਅੰਦਰਲੀ ਤ੍ਰਿਪਤੀ ਵੀ ਹੁੰਦੀ ਹੈ ਸੰਗੀਤ ਹੈ ਜਿਹੜਾ ਉਹ ਤੁਹਾਨੂੰ ਮਨ ਨੂੰ ਵੀ ਸ਼ਾਂਤੀ ਦਿੰਦਾ ਰੂਹ ਦੀ ਖ਼ੁਰਾਕ ਮੰਨਿਆ ਜਾਂਦਾ ਇਸ ਕਰਕੇ ਮੈਂ ਉਹਦੇ 'ਤੇ ਜਿਹੜੀ ਹੈ ਨਾਲੇ ਤਾਂ ਮੇਰਾ ਇਹ ਆਪਣਾ ਸ਼ੌਕ ਪੂਰਾ ਹੋਊਗਾ ਪੈਸ਼ਨ ਆ ਜਿਹੜਾ ਮੇਰਾ ਅਤੇ ਨਾਲ ਨਾਲ ਮੈਨੂੰ ਇੱਕ ਨਵੀਂ ਚੀਜ਼ ਸਿੱਖਣ ਦਾ ਮੌਕਾ ਵੀ ਮਿਲੂਗਾ